ਭੰਗੜਾ ਆਰੋਬਿਕਸ ਕਰਨ ਵਾਸਤੇ ਅੱਜ ਕੱਲ ਦੇ ਵਿੱਚ ਜੋ ਗਾਣੇ ਪ੍ਰਚਲਿਤ ਹਨ ਉਹੀ ਚੱਲ ਰਹੇ ਹਨ ਬਹੁਤ ਸਾਰੇ ਬੱਚੇ ਇਹਨਾਂ ਦੇ ਉੱਤੇ ਡਾਂਸ ਕਰਕੇ ਨਾਲ ਆਰੋਬਿਕਸ ਕਰਦੇ ਹਨ ਡਾਂਸ ਦੇ ਨਾਲ ਨਾਲ ਭੰਗੜਾ ਕਰਨਾ ਇੱਕ ਬਹੁਤ ਹੀ ਮਨੋਰੰਜਕ ਕੰਮ ਹੈ ਜੋ ਕਿ ਬੱਚੇ ਬੜੀ ਖੁਸ਼ੀ ਨਾਲ ਕਰਦੇ ਹਨ ਇਹਨਾ ਇਹਦੇ ਨਾਲ ਨਾਲ ਇਹ ਸਾਰਾ ਕੰਮ ਔਰਤਾਂ ਵੀ ਕਰਦੀਆਂ ਹਨ ਬੱਚੇ ਵੀ ਕਰਦੇ ਹਨ ਵੱਡੇ ਬਜ਼ੁਰਗ ਸਭ ਕਰ ਸਕਦੇ ਹਨ ਜਿੱਦਾਂ ਅੱਜ ਕੱਲ ਜਿਹੜੇ ਗਾਣੇ ਬਹੁਤ ਹੀ ਜਿਆਦਾ ਪ੍ਰਚਲਿਤ ਹਨ ਉਹ ਹੈ ਜੁੱਤੀ ਕਰੇ ਮੁਟਿਆਰ ਦੀ ਚੀਕੂ ਚੀਕੂ ਇਸ ਤਰ੍ਹਾਂ ਦੇ ਗਾਣੇ ਅੱਜ ਕੱਲ ਚੱਲ ਰਹੇ ਹਨ ਤੇ ਬੱਚੇ ਬਹੁਤ ਖੁਸ਼ ਹੁੰਦੇ ਹਨ ਇਹਨਾਂ ਦੇ ਉੱਤੇ ਆਰੋਬਿਕਸ ਕਰਕੇ ਤੇ ਅੱਜ ਕੱਲ ਜਿਹੜਾ ਗਾਣਾ ਸੀ ਮੇਰੀ ਕਾਲੀ ਐਕਟੀਵਾ ਦਾ ਇਕ ਦਿਨ ਖੜ ਗਿਆ ਹੈਂਡਲ ਫੜ ਕੇ ਇਹ ਗਾਣਾ ਵੀ ਚੱਲ ਰਿਹਾ ਹੈ ਔਰ ਪੰਜਾਬੀ ਟੱਪਿਆਂ ਦੇ ਉੱਤੇ ਵੀ ਚਲਦੇ ਹਨ ਬਹੁਤ ਸਾਰੇ ਗੀਤ ਬੱਚੇ ਬੁੜੇ ਅਤੇ ਔਰਤਾਂ ਬਹੁਤ ਹੀ ਖੁਸ਼ੀ ਨਾਲ ਇਹਨਾਂ ਦੇ ਉੱਤੇ ਅਰੋਬਿਕਸ ਅਤੇ ਡਾਂਸ ਕਰਦੀਆਂ ਹਨ ਅਤੇ ਇੱਕ ਗਾਣਾ ਜਿਹੜਾ ਮੈਨੂੰ ਬਹੁਤ ਪਸੰਦ ਹੈ ਉਹ ਇੱਕ ਇੱਕ ਹਿ ਹਿੰਦੀ ਸੌਂਗ ਹੈ ਵੈਸੇ ਤਾਂ ਜਿਆਦਾਤਰ ਇੰਗਲਿਸ਼ ਗਾਣਿਆਂ ਦੇ ਉੱਤੇ ਜਿਆਦਾ ਐਰੋਬਿਕਸ ਕਰਾਇਆ ਜਾਂਦਾ ਹੈ ਧੰਨਵਾਦ